ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਵਧਾਈ ਹੋਵੇ ਤੁਹਾਨੂੰ ਬੇਟਾ ਤੁਹਾਡਾ ਬਾਹਰ ਚਲੇ ਗਿਆ ਮੈਨੂੰ ਪਤਾ ਲੱਗਾ ਕੱਲ੍ਹ ਹੋਰ ਠੀਕ ਠਾਕ ਹੈ ਠੀਕ ਠਾਕ ਪਹੁੰਚ ਗਿਆ ਹਮ ਅੱਛਾ ਕਿੱਥੇ ਗਿਆ ਕੈਨੇਡਾ ਹੀ ਗਿਆ ਨਾ ਹਾਂਜੀ ਹੋਰ ਸੁਣਾਓ ਫਿਰ ਸਭ ਠੀਕ ਠਾਕ ਹੈ ਕਿੱਦਾਂ ਫਿਰ ਕਿ ਅੱਜ ਕੱਲ੍ਹ ਵੇਖ ਲਓ ਮੈਨੂੰ ਉਹੀ ਹੋਣ ਡਿਆ ਸੀ ਮੇਰੀ ਵੀ ਬੇਟੀ ਇੱਦਾਂ ਹੀ ਮਗਰ ਪਈ ਹੋਈ ਹੈ ਅੱਜ ਕੱਲ੍ਹ ਤਾਂ ਸਭ ਬੱਚਿਆਂ ਨੂੰ ਬਾਹਰ ਜਾਣ ਦੀ ਬਸ ਕਿ ਅਸੀਂ ਬਾਹਰ ਚਲੇ ਜਾਈਏ ਇੱਥੇ ਬਿਜਨਸ ਚੰਗਾ ਭਲਾ ਹੋਵੇ ਤਾਂ ਵੀ ਚਲੋ ਕੋਈ ਨਹੀਂ ਮਹਾਰਾਜ ਇਹਨਾਂ ਨੂੰ ਰਾਜ਼ੀ ਰੱਖੇ ਹਾਂ ਇਸ ਤਰ੍ਹਾਂ ਹੀ ਹੈ ਕੋਈ ਗੱਲ ਨਹੀਂ ਹਾਂ ਇਸ ਤਰ੍ਹਾਂ ਹੀ ਕਰਦੇ ਨੇ ਆਪਣਾ ਦੇਖੋ ਬਿਜਨਸ ਹੈਗਾ ਬੱਚਿਆਂ ਹਾਂਜੀ ਹਾਂਜੀ ਇਹੀ ਚੀਜ਼ ਹੈ ਨਾ ਬੱਚੇ ਨਹੀਂ ਨਾ ਸਮਝਦੇ ਕਿ ਇੱਥੇ ਵੀ ਆਪਣਾ ਬਿਜ਼ਨਸ ਹੈਗਾ ਮਾਂ ਬਾਪ ਦਾ ਉਹਨੂੰ ਸੰਭਾਲ ਲਿਓ ਅੱਗੇ ਅੱਗੇ ਕਰ ਲਈਏ ਬੱਚੇ ਆਹੀ ਸੋਚਦੇ ਕਿ ਚਲੋ ਉਹ ਗਿਆ ਉਹ ਗਿਆ ਦੂਜਾ ਗਿਆ ਮੈਂ ਵੀ ਚੱਲ ਜਾਂ ਬਾਹਰ ਚਲੋ ਕੋਈ ਗੱਲ ਨਹੀਂ ਪਰਮਾਤਮਾ ਸਾਨੂੰ ਤਾਂ ਚਲੋ ਸਾਂਭਣ ਵਾਲੇ ਹੈਗੇ ਆ ਪਿੱਛੇ ਜਿਨ੍ਹਾਂ ਕੋਲ ਉਹ ਵੀ ਦੇਖੋ ਉਹ ਵੀ ਮਾਂ ਪਿਓ ਹੈਗੇ ਜਿਹਨਾਂ ਕੋਲ ਕੋਈ ਸਾਂਭਣ ਵਾਲਾ ਨਹੀਂ ਹੈਗਾ ਹੈ ਨਾ ਉਹਨਾਂ ਵਾਸਤੇ ਕਿੰਨੀ ਔਖ ਹੁੰਦੀ ਹੈ ਹਾਂਜੀ ਹਾਂਜੀ ਚਲੋ ਕੋਈ ਨਹੀਂ ਪਰਮਾਤਮਾ ਇਹਨਾਂ ਨੂੰ ਸਕਸੈੱਸਫੁੱਲ ਕਰੇ ਹੈ ਨਾ ਇਹਨਾਂ ਨਾਲ਼ ਹੀ ਆ ਸਭ ਕੁਛ ਇਹਨਾਂ ਦਾ ਹੀ ਆ ਇੱਥੇ ਵੀ ਇਹਨਾਂ ਦਾ ਅਤੇ ਜਿਹੜਾ ਕਮਾਉਣਾ ਉਹ ਵੀ ਇਨ੍ਹਾਂ ਦਾ ਠੀਕ ਹੈ ਵੀਰ ਜੀ ਮੈਨੂੰ ਬਹੁਤ ਖੁਸ਼ੀ ਹੋਈ ਸੁਣ ਕੇ ਹੈਂ ਠੀਕ ਹੈ ਓਕੇ ਬਾਏ